ਮੈਂ ਮਾਰਕਿਟ ਆਪਣੇ ਡਰਾਈਵਰ ਨੂੰ ਬੁਲਾਇਆ ਡਰਾਈਵਰ ਨਾਲ ਨਾ ਮਾਰਕਿਟ 'ਚ ਆ ਕੇ ਵਾਪਸ ਆ ਰਹੀ ਸੀਗੀ ਅਤੇ ਰਸਤੇ 'ਚ ਨਾ ਆਈ ਆਈ ਟੀ ਦੇ ਕੋਲ ਸਾਹਮਣੇ ਗੇਟ 'ਤੇ ਨਾ ਐਕਸੀਡੈਂਟ ਹੋਇਆ ਅਤੇ ਮੈਂ ਡਰਾਈਵਰ ਨੂੰ ਆਪਣੇ ਨੂੰ ਕਿਹਾ ਤੂੰ ਕਿ ਮੈਨੂੰ ਇੱਥੇ ਲਾਹ ਦੇ ਤੂੰ ਤੂੰ ਪਹਿਲਾਂ ਇੰਝ ਕਰ ਕਿ ਜਿਹੜਾ ਤੜਫ਼ ਰਿਹਾ ਹੈ ਨਾ ਉਹਦੀ ਦੋਨੋ ਲੱਤਾਂ ਫਰੈਕਚਰ ਹੋ ਗਈਆਂ ਸੀਗੀਆਂ ਅਤੇ ਮੈਂ ਕਿਹਾ ਤੂੰ ਇੰਝ ਕਰ ਪਹਿਲਾਂ ਇਹਨੂੰ ਪਾ ਕੇ ਨਾ ਹੋਸਪੀਟਲ ਛੱਡ ਕੇ ਆ ਅਤੇ ਮੈਨੂੰ ਇੰਨਾ ਲੱਗਿਆ ਕਿ ਮੈਂ ਤਾਂ ਤੁਰ ਕੇ ਵੀ ਚਲੇ ਜਾਣਾ ਮੈਂ ਕਿਹਾ ਜਿਹੜਾ ਉਹ ਮਰੀਜ਼ ਨੂੰ ਪਿਆ ਕਿਤੇ ਉਹ ਇੰਨਾ ਕੁ ਜ਼ਿਆਦਾ ਲੱਤਾਂ ਵਗੈਰਾ ਸਿਰ 'ਚ ਚੋਟ ਲੱਗੀ ਵੀ ਸੀਗੀ ਮੈਂ ਕਿਹਾ ਇਹਨੂੰ ਕੁਛ ਹੋ ਨਾ ਜਾਵੇ ਤੂੰ ਪਹਿਲੇ ਇਹਨੂੰ ਜਾ ਕੇ ਨਾ ਪਹਿਲੇ ਹੌਸਪੀਟਲਾਈਜ਼ ਕਰਾ ਸਗੋਂ ਉਹਨੂੰ ਮੈਂ ਬਾਅਦ 'ਚ ਕਾਲ ਕਰੀ ਵੀਰ ਨੂੰ ਮੈਂ ਕਿਹਾ ਵੀਰ ਕੋਈ ਨਾ ਪੈਸੇ ਵੀ ਲੈ ਜੀ ਪਰ ਇਹਦਾ ਇਲਾਜ ਕਰਾ ਕੋਈ ਦੁਰਘਟਨਾ ਹੋ ਜੇ ਕਿ ਇੱਦਾਂ ਪਿੱਛੇ ਨਹੀਂ ਹੱਟਣਾ ਚਾਹੀਦਾ ਬੰਦੇ ਨੂੰ ਅਤੇ ਉਸ ਬੰਦੇ ਨੂੰ ਸਹੀ ਸਮੇਂ ਸਿਰ ਹੌਸਪੀਟਲ ਪਹੁੰਚਾਓ